ਸਾਡੇ ਖੇਤਰ ਵਿੱਚ ਬਹੁਤ ਸਾਰੀਆਂ ਖੇਡਾਂ ਖੇਡੀਆਂ ਜਾਂਦੀਆਂ ਹਨ ਜਿਵੇਂ ਕਿ ਅਸੀਂ ਬਚਪਨ ਵਿੱਚ ਖੇਡਦੇ ਸੀ ਗੇਂਦ ਗੀਟੇ ਕਬੱਡੀ ਔਰ ਜਿਵੇਂ ਕਿ ਅਸੀਂ ਆਪਣੇ ਬਚਪਨ ਵਿੱਚ ਹੋਰ ਬਹੁਤ ਸਾਰੀਆਂ ਖੇਡਾਂ ਖੇਡਦੇ ਸੀ ਜਿਵੇਂ ਛੂਹਣ ਛੁਪਾਈ ਔਰ ਜਿਵੇਂ ਹੋਰ ਵੀ ਬਹੁਤ ਸਾਰੀਆਂ ਕਈ ਖੇਡਾਂ ਨੇ ਜਿਹੜੀਆਂ ਅਸੀਂ ਆਪਣੇ ਬਚਪਨ 'ਚ ਖੇਡਦੇ ਸੀ ਪਰ ਜੇਕਰ ਅੰਦਰੂਨੀ ਖੇਡਾਂ ਦੀ ਗੱਲ ਕਰੀਏ ਤਾਂ ਉਹਦੇ ਵਿੱਚ ਬਹੁਤ ਸਾਰੀਆਂ ਖੇਡਾਂ ਆ ਜਾਂਦੀਆਂ ਹਨ ਜਿਵੇਂ ਕਿ ਲੁੱਡੋ ਜਿਵੇਂ ਕਿ ਸ਼ਤਰੰਜ ਔਰ ਜਿਵੇਂ ਕਿ ਕੈਰਮ ਬੋਰਡ ਔਰ ਜਿਵੇਂ ਕਿ ਬੈਡਮਿੰਟਨ ਬਿਰਗੂ ਟੇਬਲ ਟੈਨਿਸ ਔਰ ਜਿ ਅੱਜ ਕੱਲ੍ਹ ਲੋਕ ਜ਼ਿਆਦਾਤਰ ਅੰਦਰੂਨੀ ਖੇਡਾਂ ਖੇਡਦੇ ਹਨ ਔਰ ਜਿਹਦੇ ਕਾਰਨ ਬੱਚਿਆਂ ਦੇ ਵਿੱਚ ਤਣਾਅ ਔਰ ਬਹੁਤ ਸਾਰੀਆਂ ਬਿਮਾਰੀਆਂ ਪੈਦਾ ਹੁੰਦੀਆਂ ਹਨ ਇਹੀ ਬਸ ਇਸਦਾ ਕਾਰਨ ਹੈ ਕਿ ਲੋਕ ਅੱਜ ਕੱਲ੍ਹ ਅੰਦਰੂਨੀ ਖੇਡਾਂ ਖੇਡਦੇ ਹਨ ਔਰ ਬਹੁਤ ਸਾਰੇ ਲੋਕ ਬੱਚੇ ਬਿਮਾਰ ਹੁੰਦੇ ਹਨ ਔਰ ਪਹਿਲਾਂ ਲੋਕ ਜ਼ਿਆਦਾਤਰ ਬਾਹਰ ਦੇ ਮਾਹੌਲ ਵਿੱਚ ਖੇਡਾਂ ਖੇਡਦੇ ਸਨ ਜਿਵੇਂ ਕਿ ਕਬੱਡੀ ਕਰਾਟੇ ਔਰ ਕ੍ਰਿਕਟ ਇਹੋ ਜਿਹੀਆਂ ਬਹੁਤ ਸਾਰੀਆਂ ਖੇਡਾਂ ਜਿਹੜੀਆਂ ਪਹਿਲਾਂ ਲੋਕ ਬਾਹਰ ਦੇ ਮਾਹੌਲ ਵਿੱਚ ਖੇਡਦੇ ਸਨ ਔਰ ਸਾਡੀ ਜੇਕਰ ਜ਼ਿਕਰ ਕਰੀਏ ਸਾਡੇ ਪੰਜਾਬ ਦੀ ਅੰਤਰਰਾਸ਼ਟਰੀ ਖੇਡ ਕਬੱਡੀ ਹੈ ਔਰ ਸਾਨੂੰ ਬਹੁਤ ਮਾਣ ਹੈ ਕਿ ਸਾਡੀ ਸਾਡੇ ਦੇਸ਼ ਦੀ ਕਬੱਡੀ ਦੀ ਖੇਡ ਜਿਹੜੀ ਬਾਹਰਲੇ ਦੇਸ਼ਾਂ ਵਿੱਚ ਵੀ ਖੇਡੀ ਜਾਂਦੀ ਹੈ